ਹਾਂ ਅਸੀਂ ਆਪਣੇ ਮੋਬਾਇਲ 'ਤੇ ਰੋਜ਼ ਦਾ ਜੋ ਵੀ ਨਵੀਂ ਨਵੀਂ ਅਪਡੇਟ ਵਗੈਰਾ ਆਉਂਦੀ ਹੈ ਆਪਾਂ ਪੜ੍ਹਦੇ ਹਾਂ ਸਭ ਤੋਂ ਪਹਿਲੇ ਅਗਰ ਅਤੇ ਆਪਾਂ ਦੇਖਣਾ ਚਾਹੁੰਦੇ ਹਨ ਕਿ ਅਗਰ ਆਪਾਂ ਦੂਰ ਰਹਿੰਦੇ ਹਾਂ ਅਤੇ ਅਗਰ ਕੋਈ ਬੱਚਾ ਕੋਲੇਜ ਜਾਂ ਸਕੂਲ ਵਿੱਚ ਪੜ੍ਹਦਾ ਹੈ ਅਗਰ ਅਤੇ ਉਹਨੇ ਦੇਖਣਾ ਹੋਵੇ ਕਿ ਅੱਜ ਪੂਰੇ ਭਾਰਤ ਬੰਦ ਹੈ ਉਹਦੀ ਦੇਖਣਾ ਹੋਵੇ ਕਿ ਹਾਂ ਅੱਜ ਸਾਰੇ ਸਕੂਲ ਵਗੈਰਾ ਬੰਦ ਹਨ ਕਿ ਨਹੀਂ ਬੰਦ ਉਹ ਸਾਰੇ ਅਪਡੇਟ ਗੂਗਲ ਵਗੈਰਾ ਵਰਗੀ ਸਾਈਟ ਐਪ 'ਤੇ ਆ ਜਾਂਦੀਆਂ ਹਨ ਅਤੇ ਆਪਾਂ ਹਾਂ ਆਪਾਂ ਮੋਬਾਇਲ ਦੇ ਵਿੱਚ ਨਿਊਜ਼ ਫੀਡ ਵਗੈਰਾ ਪੜ੍ਹਦੇ ਹਾਂ ਅੱਜ ਤੱਕ ਅੱਜ ਦੀ ਲੇਟੈਸਟ ਨਿਊਜ਼ ਇਹ ਚੱਲ ਰਹੀ ਹੈ ਕਿ ਜਿਵੇਂ ਕਿਸਾਨਾਂ ਨੇ ਆਪਣੀ ਆਪਣੇ ਲੀਏ ਧਰਨਾ ਦਿੱਤਾ ਗਿਆ ਹੋਇਆ ਹੈ ਕਿ ਕਿਸਾਨ ਚਾਹੁੰਦੇ ਹਨ ਕਿ ਜੋ ਸਾਡੀ ਜ਼ਮੀਨ ਹੈ ਉਹ ਸਾਡੀ ਹੀ ਰਹੇ ਆਪਾਂ ਹੁਣ ਕੁੱਛ

ਹਾਂ ਕੀ ਕ ਕੌਣ ਅਗਰ ਆਪਾਂ ਅਗਰ ਫੋਰ ਇਗਜ਼ੈਮਪਲ ਅਗਰ ਆਪਾਂ ਜੋਬ ਵਗੈਰਾ ਦੀ ਦੇਖਣਾ ਹੋਵੇ ਤਾਂ ਆਪਾਂ ਕੀ ਕਰਦੇ ਆ ਕਿ ਆਪਾਂ ਜੋਬ ਵਗੈਰਾ ਵਾਲੀ ਸਾਈਟ 'ਤੇ ਚਲੇ ਜਾਂਦੇ ਹਾਂ ਅ ਸਾਨੂੰ ਨਿਊਜ਼ ਮਿਲ ਜਾਂਦੀ ਹੈ ਕਿ ਇਹ ਇਹ ਵਾਲੀ ਜੋਬਸ ਹੈ ਇਹ ਇਹ ਵਾਲੀ ਚੀਜ਼ਾਂ ਹੈਗੀਆਂ ਅਗਰ ਆਪਾਂ ਦੇਖਣਾ ਚਾਹੀਏ ਕਿ ਅਗਰ ਆਪਾਂ ਕਿਹੜੀ ਵੀ ਚੀਜ਼ ਦੀ ਸਾਈਟ ਨੂੰ ਐਲੋਅ ਕੀਤਾ ਹੋਇਆ ਹੈ ਜਿਵੇਂ ਕਿ ਬਿਊਟੀ ਪਾਰਲਰ ਵਾਲੀ ਸਾਈਟ ਨੂੰ ਅਗਰ ਤੇ ਉਹ ਦੱਸਦੇ ਹਨ ਕਿ ਇਹ ਕਰੀਮ ਸਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਅਗਰ ਆਪਾਂ ਹੋਰ ਵੀ ਬਹੁਤ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਆਪਾਂ ਅਗਰ ਲ ਕਹਿ ਦਿੱਤਾ ਜਾਵੇ ਕਿ ਸਟੱਡੀ ਰਿਲੇਟਿਡ ਸਟੱਡੀ ਰਿਲੇਟਿਡ ਜੇ ਅਗਰ ਆਪਾਂ ਆਪਣੀ ਸਾਈਟ ਨੂੰ ਐਲੋਅ ਕੀਤਾ ਹੋਇਆ ਤਾਂ ਉਹ ਕੀ ਕਰਦੇ ਹਨ ਕਿ ਜਿਹੜੇ ਚੀਜ਼ ਦੇ ਬਾਰੇ ਆਪਾਂ ਸਰਚ ਕਰਦੇ ਹਾਂ ਉਹ ਚੀਜ਼ ਦੇ ਅਕੋਰਡਿੰਗ ਉਹ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨਿਊਜ਼ ਵਗੈਰਾ 'ਤੇ ਆ ਜਾਂਦੀਆਂ ਹਨ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਵੀ ਸੁਰੱਖਿਆ ਵਗੈਰਾ ਸਭ ਇਹ ਸਭ ਚੀਜ਼ਾਂ ਨਿਊਜ਼ ਫੀਡ ਮਤਲਬ ਮੋਬਾਇਲ 'ਤੇ ਆ ਜਾਂਦੀਆਂ